ਚੌਵੀ ਫਰਵਰੀ ਦੋ ਹਜ਼ਾਰ ਗਿਆਰਾਂ ਛੱਬੀ ਫਰਵਰੀ ਉੱਨੀ ਸੌ ਨੱਬੇ ਨੌ ਜਨਵਰੀ ਉੱਨੀ ਸੌ ਬਾਨ੍ਹਵੇਂ ਇਕੱਤੀ ਅਕਤੂਬਰ ਦੋ ਹਜ਼ਾਰ ਸਤਾਰ੍ਹਾਂ ਪੰਜ ਫਰਵਰੀ ਦੋ ਹਜ਼ਾਰ ਸਤਾਰ੍ਹਾਂ